ਭੰਗੜਾ ਇੱਕ ਪ੍ਰੰਪਰਾਗਤ ਪੰਜਾਬੀ ਨਾਚ ਰੂਪ ਇਸੇ ਊਰਜਾਬੰਧ ਅਤੇ ਜਸ਼ਨ ਮਨਾਉਣ ਵਾਲੇ ਸੁਭਾਅ ਲਈ ਮਸ਼ਹੂਰ ਹੈ ਜੋ ਕਿ ਕਈ ਤਰ੍ਹਾਂ ਦੇ ਗਤੀਸ਼ੀਲ ਕਦਮਾਂ ਅਤੇ ਅੰਦੋਲਨਾਂ ਦੁਆਰਾ ਪ੍ਰਗਟ ਹੁੰਦਾ ਹੈ ਆਮ ਕਦਮਾਂ ਵਿੱਚ ਝੂਮਰ ਸ਼ਾਮਲ ਹੁੰਦਾ ਹੈ ਜਿਸ ਵਿੱਚ ਤਾਲਬੰਧ ਉਛਾਲ ਭਰੀਆਂ ਹਰਕਤਾਂ ਹੁੰਦੀਆਂ ਹਨ ਜੋ ਜੀਵਤ ਉਤਸ਼ਾਹ ਦੀ ਭਾਵਨਾ ਪੈਦਾ ਕਰਦੀਆਂ ਹਨ ਧਮਾਲ ਵਿੱਚ ਜ਼ੋਰਦਾਰ ਛਲਾਂਗ ਅਤੇ ਚੌੜੀਆਂ ਬਾਹਾਂ ਦੇ ਝੂਲੇ ਸ਼ਾਮਿਲ ਹੁੰਦੇ ਹਨ ਜੋ ਡਾਂਸ ਦੀ ਉੱਚ ਊਰਜਾ ਅਤੇ ਛੂਤ ਵਾਲੀ ਭਾਵਨਾ ਵਿੱਚ ਯੋਗਦਾਨ ਪਾਉਂਦੇ ਹਨ ਇੱਕ ਹੋਰ ਮੁੱਖ ਕਦਮ ਤੂੰਬੀ ਹੈ ਜਿਸ ਵਿੱਚ ਤੇਜ਼ ਫੁਟਵਰਕ ਅਤੇ ਤੇਜ਼ ਤਿੱਖੇ ਮੋੜ ਹਨ ਜੋ ਚੁਸਤੀ ਅਤੇ ਤਾਲਮੇਲ ਦਾ ਪ੍ਰਦਰਸ਼ਨ ਕਰਦੇ ਹਨ ਕਿੱਕਲੀ ਵਿੱਚ ਭਾਗੀਦਾਰਾਂ ਨਾਲ ਸਮਕਾਲੀ ਤਰੀਕੇ ਨਾਲ ਸਪਿਨ ਕਰਨਾ ਸ਼ਾਮਿਲ ਹੁੰਦਾ ਹੈ ਜਿਸ ਨਾਲ ਏਕਤਾ ਅਤੇ ਤਾਲ ਦਾ ਇੱਕ ਦ੍ਰਿਸ਼ਟੀਗਤ ਮਨਮੋਹਕ ਪ੍ਰਦਰਸ਼ਨ ਹੁੰਦਾ ਹੈ ਇਹ ਕਦਮ ਰਵਾਇਤੀ ਪੰਜਾਬੀ ਸੰਗੀਤ ਦੀਆਂ ਧੜਕਣਾਂ ਵਾਲੀਆਂ ਬੀਟਾਂ ਖਾਸ ਕਰਕੇ ਢੋਲ ਢੋਲ ਜੋ ਕਿ ਡਾਂਸ ਦੀ ਲੈਰਮਿਕ ਤੀਬਰਤਾ ਅਤੇ ਅਨੰਦਮਈ ਮਾਹੌਲ ਨੂੰ ਚਲਾਉਂਦੇ ਹਨ ਲਈ ਕੀਤੇ ਜਾਂਦੇ ਹਨ ਇਨ੍ਹਾਂ ਕਦਮਾਂ ਦਾ ਜੀਵੰਤ ਉਤਸ਼ਾਹਿਤ ਸੁਭਾਅ ਜੋਸ਼ੀਲੇ ਸੰਗੀਤ ਦੇ ਨਾਲ ਪੰਜਾਬੀ ਸੱਭਿਆਚਾਰਕ ਦੇ ਜਸ਼ਨ ਦੇ ਤੱਤ ਨੂੰ ਦਰਸਾਉਂਦਾ ਹੈ ਫਿਰਕੂ ਭਾਵਨਾ ਤਿਉਹਾਰ ਅਤੇ ਸੱਭਿਆਚਾਰਕ ਮਾਣ 'ਤੇ ਜ਼ੋਰ ਦਿੰਦਾ ਹੈ ਭੰਗੜੇ ਦੀ ਸਰੀਰਿਕ ਜੋਸ਼ ਅਤੇ ਤਾਲ ਦੀ ਸ਼ੁੱਧਤਾ ਨਾ ਸਿਰਫ਼ ਰਵਾਇਤੀ ਵਾਢੀ ਦੇ ਤਿਉਹਾਰ ਅਤੇ ਸਮਾਜਿਕ ਇਕੱਠਾਂ ਨੂੰ ਮਨਾਉਂਦੀ ਹੈ ਬਲਕਿ ਪੰਜਾਬੀ ਜੀਵਨ ਦੇ ਪ੍ਰਚੰਡ ਅਤੇ ਸੰਪਰਦਾਇਕ ਸੁਭਾਅ ਦਾ ਵੀ ਪ੍ਰਤੀਕ ਹੈ